ਮੈਨੂੰ ਖੇਡਾਂ ਬਾਰੇ ਇੰਨੀ ਜਾਣਕਾਰੀ ਤਾਂ ਨਹੀਂ ਹੈ ਫਿਰ ਵੀ ਮੈਨੂੰ ਇੱਕ ਅੱਧੀ ਖੇਡ ਬਾਰੇ ਜਾਣਕਾਰੀ ਹੈ ਜਿਵੇਂ ਕਿ ਕ੍ਰਿਕਟ ਵਿੱਚ ਰਣਜੀ ਟਰਾਫੀ ਬਾਰੇ ਜਾਣਦੇ ਹਾਂ ਇਸ ਵਿੱਚ ਇਹ ਟਰੋਫੀ ਜਿਹੜੀ ਹੈ ਕ੍ਰਿਕਟ ਖਿਡਾਰੀਆਂ ਨੂੰ ਦਿੱਤੀ ਜਾਂਦੀ ਹੈ ਇਸ ਵਿੱਚ ਜਿਹੜਾ ਬੱਚਾ ਬਹੁਤ ਜ਼ਿਆਦਾ ਮਿਹਨਤ ਕਰਦਾ ਉਸਨੂੰ ਇਹ ਰਣਜੀ ਟਰੋਫੀ ਦਿੱਤੀ ਜਾਂਦੀ ਹੈ ਜਿਸ ਵਿੱਚ ਖੇਡ ਕੇ ਬੱਚਾ ਅੱਗੇ ਸਟੇਟ ਲੈਵਲ 'ਤੇ ਰਾਜ ਪੱਧਰ 'ਤੇ ਖੇਡ ਕੇ ਅੰਤਰਰਾਸ਼ਟਰੀ ਖੇਡ ਖੇਡ ਸਕਦਾ ਹੈ ਇਸ ਨੂੰ ਪ੍ਰਾਪਤ ਕਰਨ ਲਈ ਬਹੁਤ ਹੀ ਮਿਹਨਤ ਦੀ ਜ਼ਰੂਰਤ ਹੁੰਦੀ ਹੈ